ਹਾਂਜੀ ਅਸੀਂ ਬਚਪਨ 'ਚ ਬਹੁਤ ਸਾਈਕਲ ਚਲਾਉਂਦੇ ਹੁੰਦੇ ਸੀ ਅਤੇ ਬਚਪਨ 'ਚ ਇੰਨੀ ਥਕਾਵਟ ਵੀ ਨਹੀਂ ਹੁੰਦੀ ਸੀ ਪਰ ਹੁਣ ਹੁਣ ਜਦੋਂ ਦੇ ਵੱਡੇ ਹੋਏ ਹਾਂ ਕਾਫ਼ੀ ਟਾਈਮ ਤੋਂ ਛੱਡਿਆ ਹੋਇਆ ਸੈਂਕਲ ਉਦੋਂ ਦੀ ਬਹੁਤ ਦਿੱਕਤ ਆਉਂਦੀ ਹੈ ਕਾਫ਼ੀ ਟਾਈਮ ਪਹਿਲਾਂ ਮੈਂ ਸਾਈਕਲ ਚਲਾਇਆ ਸੀ ਲਾਸਟ ਵਾਰ ਅਤੇ ਉਦੋਂ ਵੀ ਕਾਫ਼ੀ ਦਿੱਕਤ ਆਈ ਸੀ ਮੈਂ ਦਸ ਕੁ ਕਿਲੋਮੀਟਰ ਦੂਰ ਮੁਕਤਸਰ ਤੋਂ ਗਈ ਹੋਈ ਸੀ ਅਤੇ ਇੰਨੀਆਂ ਜ਼ਿਆਦਾ ਲੱਤਾਂ ਦਰਦ ਕਰਦੀਆਂ ਸੀ ਅਤੇ ਬਾਹਾਂ ਅਤੇ ਸਿਰ ਵੀ ਬਹੁਤ ਦਰਦ ਕਰਦਾ ਸੀ ਅਤੇ ਕ ਚੱਕਰ ਵੀ ਆਂਉਦੇ ਸੀ ਬਹੁਤ ਦਿੱਕਤ ਆਂਉਦੀ ਸੀ ਲੱਤਾਂ ਵੀ ਪੈਰ ਵੀ ਬਹੁਤ ਦਰਦ ਕਰਦੇ ਸੀ ਜਦੋਂ ਮੈਂ ਘਰ ਵਾਪਿਸ ਆਈ ਤਾਂ ਬਹੁਤ ਸਾਰੀਆਂ ਲੱਤਾਂ ਅਤੇ ਪੈਰ ਦਰਦ ਕਰਨ ਲੱਗ ਗਏ ਅਤੇ ਇਹਦੇ ਕਈ ਸਹੀ ਵੀ ਹਨ ਫਾਇਦੇ ਸਾਇਕਲ ਚਲਾਉਣ ਨਾਲ ਜੇ ਆਪਾਂ ਡੇਲੀ ਬੇਸ 'ਤੇ ਚਲਾਈਏ ਤਾਂ ਸਾਈਕਲ ਸਹੀ ਵੀ ਆ ਜੇ ਆਪਾਂ ਕਈ ਵਾਰ ਚਲਾਵਾਂਗੇ ਤਾਂ ਦਿੱਕਤ ਵੀ ਆਉਂਦੀ ਹੈ ਕਿਉਂਕਿ ਪਹਿਲਾਂ ਸਾਈਕਲ ਡੇਲੀ ਬੇਸ 'ਤੇ ਚਲਾਉਂਦੇ ਸੀ ਤਾਂ ਕੋਈ ਦਿੱਕਤ ਨਹੀਂ ਆਉਂਦੀ ਸੀ ਹੁਣ ਕਾਫ਼ੀ ਟਾਈਮ ਬਾਅਦ ਸਾਈਕਲ ਚਲਾਉਂਦੇ ਹਾਂ ਤਾਂ ਦਿੱਕਤ ਆਉਂਦੀ ਆ ਅਤੇ ਕਈ ਟਾਈਮ ਪਹਿਲਾਂ ਮੈਂ ਸਾਇਕਲ ਛੱਡਿਆ ਸੀ ਅਤੇ ਦਿੱਕਤ ਵੀ ਆਈ ਸੀ ਬਹੁਤ ਪਰ ਹੁਣ ਸਾਈਕਲ ਜੇ ਮੰਨ ਕੇ ਚੱਲੋ ਆਪਾਂ ਡੇਲੀ ਬੇਸ 'ਤੇ ਚਲਾਵਾਂਗੇ ਤਾਂ ਇੰਨੀ ਦਿੱਕਤ ਨਹੀਂ ਆਉਂਦੀ ਇਹਦੇ ਫਾਇਦੇ ਵੀ ਹਨ ਸਾਈਕਲ ਚਲਾਉਣ ਦੇ ਡੇਲੀ ਬੇਸ 'ਤੇ ਸਰੀਰ ਫਰੈਸ਼ ਰਹਿੰਦਾ ਅਤੇ ਲੱਤਾਂ ਬਾਹਾਂ ਨਹੀਂ ਦਰਦ ਕਰਦੀਆਂ ਅਤੇ ਇਹਦੇ ਨਾਲ ਸਰੀਰ ਦੀ ਫਿ ਫਿਟਿੰਗ ਵੀ ਸਹੀ ਰਹਿੰਦੀ ਹੈ ਅਤੇ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਆ ਅਤੇ ਇਹਦੇ ਨਾਲ ਸਿਹਤ ਵੀ ਬਹੁਤ ਵਧੀਆ ਰਹਿੰਦੀ ਹੈ ਅਤੇ ਸਾਨੂੰ ਇੰਨਾ ਮਤਲਬ ਕਿ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਦਸ ਵੀਹ ਮਿੰਟ ਡੇਲੀ ਬੇਸ 'ਤੇ ਅਸੀਂ ਚਲਾਉਂਦੇ ਹਾਂ ਅਤੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਵਧੀਆ ਫਰੈਸ਼ ਰਹਿੰਦਾ ਸਰੀਰ ਜੇ ਲੇਟ ਚਲਾਉਂਦੇ ਹਾਂ ਤਾਂ ਟੈਮ ਲੱਗ ਜਾਂਦਾ ਅਤੇ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਡੇਲੀ ਬੇਸ 'ਤੇ ਹੀ ਸਾਇਕਲ ਚਲਾਉਣਾ ਚਾਹੀਦਾ ਹੈ ਜੇ ਅਸੀਂ ਲੇਟ ਚਲਾਵਾਂਗੇ ਤਾਂ ਸਾਨੂੰ ਦਿੱਕਤ ਵੀ ਸਹਿਣੀ ਪੈਣੀ ਹੈ